ਮੈਂ ਘੁੰਮਣ ਦਾ ਬੜਾ ਸ਼ੌਕੀਨ ਹਾਂ ਅਤੇ ਮੈਨੂੰ ਘੁੰਮਣਾ ਬਹੁਤ ਹੀ ਜ਼ਿਆਦਾ ਪਸੰਦ ਹੈ ਜ਼ਿਆਦਾਤਰ ਮੈਨੂੰ ਠੰਡਾ ਇਲਾਕਾ ਪਹਾੜੀ ਇਲਾਕਾ ਵਿੱਚ ਜਾਣਾ ਮੈਂ ਪਸੰਦ ਕਰਦਾ ਹਾਂ ਪਿੱਛੇ ਮੈਂ ਹੇਮਕੁੰਡ ਸਾਹਿਬ ਜਾ ਕੇ ਆਇਆ ਉੱਥੇ ਮੈਂ ਮੱਥਾ ਟੇਕਿਆ ਅਤੇ ਆਉਂਦੇ ਹੋਏ ਰਿਸ਼ੀਕੇਸ਼ ਘੁੰਮਿਆ ਉਥੇ ਇਹ ਸਾਰਾ ਪਹਾੜੀ ਇਲਾਕਾ ਉੱਥੇ ਦੀ ਲੋਕ ਬਹੁਤ ਵਧੀਆ ਅਤੇ ਅਤੇ ਮੈਨੂੰ ਜ਼ਿਆਦਾ ਬਾਈਕ 'ਤੇ ਜਾਣਾ ਮੈਂ ਜ਼ਿਆਦਾ ਪਸੰਦ ਕਰਦਾ ਹਾਂ ਅਤੇ ਬਾਈਕ ਵਿੱਚ ਮੈਂ ਕਿਤੇ ਵੀ ਰਸਤੇ ਕਿਤੇ ਵੀ ਮੌੜ 'ਤੇ ਰੁਕ ਸਕਦਾ ਹਾਂ ਅਤੇ ਆਪਣਾ ਜੋ ਦਿਲ ਕਰਿਆ ਕੋਈ ਨਜ਼ਾਰਾ ਕੋਈ ਪਹਾੜ ਦਾ ਨਜ਼ਾਰਾ ਪਹਾੜ ਦੇ ਉੱਪਰ ਅਤੇ ਨੀਚੇ ਵੱਲ ਨੂੰ ਦੇਖਣਾ ਨੀਚੇ ਅਤੇ ਉੱਪਰ ਵੱਲ ਨੂੰ ਦੇਖਣਾ ਬਹੁਤ ਵਧੀਆ ਲੱਗਦਾ ਹੈ ਅਤੇ ਉੱਥੇ ਰੁਕ ਕੇ ਅਸੀਂ ਫੋਟੋਆਂ ਵੀ ਖਿੱਚਦੇ ਹਨ ਤਾਂ ਕਿ ਸਾਡੀ ਇੱਕ ਯਾਦ ਬਣੀ ਰਵੇ ਅਤੇ ਅਸੀਂ ਘੁੰਮ ਕੇ ਆਏ ਰਿਸ਼ੀਕੇਸ਼ ਅਤੇ ਸ਼੍ਰੀ ਹੇਮਕੁੰਡ ਸਾਹਿਬ ਹੁਣ ਮੇਰਾ ਫਿਰ ਵੀ ਦੁਬਾਰਾ ਦਿਲ ਕਰਦਾ ਹੈ ਕਿ ਮੈਂ ਰਿਸ਼ੀਕੇਸ਼ ਜਾ ਕੇ ਆਵਾਂ ਹੇਮਕੁੰਡ ਸਾਹਿਬ ਜਾ ਕੇ ਆਵਾਂ ਕਿਉਂਕਿ ਰਿਸ਼ੀਕੇਸ਼ ਜਗ੍ਹਾ ਮੈਨੂੰ ਬਹੁਤ ਜ਼ਿਆਦਾ ਪਸੰਦ ਆਈ ਉੱਥੇ ਦੇ ਮੈਨੂੰ ਝੂਲੇ ਘੁੰਮਣਾ ਫਿਰਨਾ ਮੰਦਰਾਂ ਵਿੱਚ ਜਾਣਾ ਅਤੇ ਉੱਥੇ ਦੇ ਰੀਤੀ ਰਿਵਾਜਾਂ ਨੂੰ ਸਮਝਣਾ ਅਤੇ ਦੇਖਣਾ ਬਹੁਤ ਹੀ ਵਧੀਆ ਲੱਗਿਆ